ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਆਰਟ ਐਂਡ ਕਰਾਫਟ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਇਸ ਤਰ੍ਹਾਂ ਹੀ ਮੈਨੂੰ ਅਲੱਗ ਅਲੱਗ ਕਾਰੀਗਰਾਂ ਦੀਆਂ ਕਲਾਮਾਂ ਦੇਖਣ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਇੱਥੇ ਸ ਜਿਵੇਂ ਸਾਡੇ ਇਲਾਕੇ ਵਿੱਚ ਵੀ ਬਹੁਤ ਸਾਰੇ ਕਾਰੀਗਰ ਹਨ ਅਤੇ ਅੱਜ ਕੱਲ੍ਹ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਘੁਮਿਆਰ ਆਪਣੇ ਆਪਣੇ ਕਾਰੋਬਾਰ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਰਹੇ ਹਨ ਜਿਵੇਂ ਦੀਵਾਲੀ 'ਤੇ ਦੀਵੇ ਲਾਲਟੇਨ ਮੋਮਬੱਤੀਆਂ ਅਤੇ ਹੱਟੀਆਂ ਜੋ ਕਿ ਮਿੱਟੀ ਦੀਆਂ ਬਣੀਆਂ ਹੋਈਆਂ ਹਨ ਬਣੀਆਂ ਹੁੰਦੀਆਂ ਹਨ ਅਤੇ ਉਹ ਬਹੁਤ ਸੋਹਣੀਆਂ ਸੋਹਣੀਆਂ ਡੈਕੋਰੇਟ ਕਰਕੇ ਵੇਚਦੇ ਹਨ ਅਤੇ ਸਰਕਾਰ ਵੀ ਉਹਨਾਂ ਨੂੰ ਇਹਨਾਂ ਆਪਣੇ ਛੋਟੇ ਲੈਵਲ 'ਤੇ ਬਿਜਨਸ ਨੂੰ ਚਲਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਨੂੰ ਫੰਡਿੰਗ ਵੀ ਦਿੰਦੀ ਹੈ ਕਰਜ਼ੇ ਵੀ ਦਿੰਦੀ ਹੈ ਪੰਜਾਹ ਸੱਠ ਹਜ਼ਾਰ ਤੱਕ ਆਪਣੇ ਛੋਟੇ ਬਿਜਨਸ ਨੂੰ ਚਲਾ ਸਕਣ ਅਤੇ ਉਹਨਾਂ ਨੂੰ ਸਬਸਿਡੀਆਂ ਵੀ ਦਿੰਦੀ ਹੈ ਸਰਕਾਰ ਅਗਰ ਉਹਨਾਂ ਦੇ ਕੰਮ ਕਾਰ ਵਧੀਆ ਚੱਲਣ ਅਤੇ ਔਰਤਾਂ ਨੂੰ ਵੀ ਸਬਸਿਡੀਆਂ ਦਿੰਦੀ ਹੈ ਅਲੱਗ ਅਲੱਗ ਜੇ ਔਰਤ ਵੀ ਆਪਣੇ ਔਰਤਾਂ ਆਪਣੇ ਕੰਮਾਂ ਕਾਰਾਂ ਨੂੰ ਕਰਨ ਇਹ ਆਪਣੇ ਬਿਜਨਸ ਨੂੰ ਚਲਾਉਣ ਵਿੱਚ ਉਹਨਾਂ ਨੂੰ ਜ਼ਰੂਰਤ ਹੋਵੇ ਪੈਸੇ ਦੀ ਤਾਂ ਸਰਕਾਰ ਉਹਨਾਂ ਨੂੰ ਅਲੱਗ ਅਲੱਗ ਲੈਵਲ 'ਤੇ ਅਲੱਗ ਅਲੱਗ ਤਰ੍ਹਾਂ ਨਾਲ ਸਬਸਿਡੀਆਂ ਕਰਜ਼ੇ ਅਤੇ ਫੰਡਿੰਗ ਦਿੰਦੀ ਹੈ ਅਤੇ ਇਹ ਇਸ ਤਰ੍ਹਾਂ ਬਹੁਤ ਸਾਰੀਆਂ ਕਲਾਵਾਂ ਹਨ ਜਿਹਨਾਂ ਨੂੰ ਵਧੇਰੇ ਮਾਨਤਾ ਦੀ ਲੋੜ ਹੈ ਜਿਵੇਂ ਮੇਲੇ ਲੱਗਦੇ ਹਨ ਹਰ ਸਾਲ ਪਿੰਡਾਂ ਵਿੱਚ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਛੋਟੇ ਲੈਵਲ ਦੇ ਬਿਜਨਸ ਹਨ ਉਹਨਾਂ ਨੂੰ ਉਹਨਾਂ ਨੂੰ ਆਪਣੇ ਬਿਜਨਸ ਨੂੰ ਚਲਾਉਣ ਲਈ ਅਤੇ ਆਪਣੇ ਹੁਨਰ ਨੂੰ ਲੋਕਾਂ ਨੂੰ ਦਿਖਾਉਣ ਲਈ ਉਹਨਾਂ ਨੂੰ ਫੰਡਿੰਗ ਦੇਣੀ ਚਾਹੀਦੀ ਸਬਸਿਡੀਆਂ ਦੇਣੀਆਂ ਚਾਹੀਦੀਆਂ ਕਰਜ਼ੇ ਦੇਣੇ ਚਾਹੀਦੇ ਤਾਂ ਜੋ ਆਪਣੇ ਬਿਜਨਸ ਨੂੰ ਵਧਾ ਸਕਣ ਅਤੇ ਆਪਣੇ ਹੁਨਰ ਨੂੰ ਲੋਕਾਂ ਵਿੱਚ ਦਿਖਾ ਸਕਣ